ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਹੋ ਬਸ ਜੀ ਹੋਰ ਕਿੱਦਾਂ ਫੋਨ ਕੀਤਾ ਹਾਂਜੀ ਸਾਰੇ ਵਧੀਆ ਬੱਚੇ ਵੀ ਵਧੀਆ ਤੁਸੀਂ ਸੁਣਾਓ ਹੋਰ ਕਿਵੇਂ ਫੋਨ ਕੀਤਾ ਹਾਂਜੀ ਹਾਂਜੀ ਹਾਂਜੀ ਸੀ ਬੀ ਐਸ ਈ ਬੋਰਡ ਵਧੀਆ ਬਹੁਤ ਵਧੀਆ ਪੜ੍ਹਾਈ ਵੀ ਇੱਥੇ ਬਹੁਤ ਵਧੀਆ ਆ ਫੀਸ ਦਾ ਵੀ ਬਹੁਤ ਵਧੀਆ ਅਤੇ ਤੁਸੀਂ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ

ਹਾਂਜੀ ਜੀ ਹਾਂਜੀ ਸੀ ਬੀ ਐਸ ਈ ਵਿੱਚ ਤਾਂ ਇੰਗਲਿਸ਼ ਜਿਹੜੀ ਆ ਬਹੁਤ ਵਧੀਆ ਬੱਚਾ ਇੱਥੇ ਬ ਇੰਗਲਿਸ਼ 'ਚ ਜ਼ਿਆਦਾ ਟਰੇਨ ਹੁੰਦਾ

ਹਾਂ ਵੀ ਬੇਸ ਤਾਂ ਬਣ ਜਾਂਦਾ ਅਤੇ ਹਾਂਜੀ

ਹਾਂ ਹੋਰ ਹਾਂ ਉਹ ਤਾਂ ਹੈ ਪਰ ਸੀ ਬੀ ਐਸ ਈ ਬੋਰਡ ਵਿੱਚ ਜਿੰਨੀਆਂ ਜ਼ਿਆਦਾ ਫਸਲਿਟੀਜ਼ ਆ ਓਨੀ ਹੀ ਜ਼ਿਆਦਾ ਫੀਸ ਵੀ ਜ਼ਿਆਦਾ ਹੀ ਹੈ ਇੱਥੇ ਪਰ ਇਹ ਹੈ ਕਿ ਬੇਸ ਜਿਹੜਾ ਆ ਉਹ ਬਣ ਜਾਂਦਾ ਇੱਥੇ ਬੱਚੇ ਦਾ ਹਾਂਜੀ ਉਹੀ ਹੈ ਹਾਂਜੀ ਹਾਂਜੀ

ਹਾਂਜੀ ਹਾਂਜੀ ਇੱਥੇ ਵੀ ਸਾਰਾ ਕੁਛ ਹੈਗਾ ਆ ਬਸ ਇੱਥੇ ਕੀ ਆ ਫੀਸ ਜ਼ਿਆਦਾ ਆ ਹ ਨਹੀਂ ਹੁਣ ਅਤੇ ਪੰਜਾਬ ਬੋਰਡ ਵੀ ਵਧੀਆ ਹੀ ਹੈ ਇ ਜ਼ ਇੰਨਾ ਜ਼ਿਆਦਾ ਕੁਛ ਖਾਸ ਨਹੀਂ ਹੈ ਸੀ ਬੀ ਐਸ ਈ ਦੋਨਾਂ ਵਿੱਚ ਫਰਕ ਨਹੀਂ ਹੈ ਅਤੇ ਤੁਸੀਂ ਰਹਿਣ ਦਿਉ ਉਹਨਾਂ ਦਾ ਬੇਸ ਪੰਜਾਬ ਬੋਰਡ 'ਚੋਂ ਵੀ ਬਣ ਜਾਣਾ ਜਿੰਨੀ ਕੁ ਜ਼ਿਆਦਾ ਫੈਸਿਲਿਟੀਜ਼ ਆਈਆਂ ਪੜ੍ਹਾਈ ਇੱਥੇ ਦੋਨਾਂ 'ਚ ਸੇਮ ਹੀ ਹੁੰਦੀ ਆ ਹਾਂਜੀ ਹਾਂਜੀ ਹਾਂਜੀ ਤਾਂ ਫਿਰ ਤੁਸੀਂ ਰਹਿਣ ਦਿਉ ਪੰਜਾਬ ਬੋਰਡ ਵਿੱਚ ਹੀ ਠੀਕ ਹੈ ਜੀ